ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੇ ਓਨਲਾਈਨ ਤੋਂ ਸ਼ੋਪਿੰਗ ਕੀਤੀ ਸੀ ਇੱਕ ਸੂਟ ਮੰਗਵਾਇਆ ਗਰੀਨ ਕਲਰ ਦਾ ਔਰ ਡਬਲ ਐਕਸਲ ਸਾਈਜ਼ ਪਰ ਦਾ ਮੈਨੂੰ ਐਲ ਸਾਈਜ਼ ਅਤੇ ਕਲਰ ਵੀ ਪਿੰਕ ਮਿਲਿਆ ਮੈਂ ਪਹਿਲਾਂ ਵੀ ਤੁਹਾਡੇ ਓਨਲਾਈਨ ਸ਼ੋਪਿੰਗ ਕੀਤੀ ਹੈ ਬਹੁਤ ਵਧੀਆ ਮੇਰਾ ਸਮਾਨ ਬਹੁਤ ਵਧੀਆ ਮੈਨੂੰ ਸਾਈਜ਼ ਆਉਂਦੇ ਆ ਪਰ ਹੁਣ ਸਾਈਜ਼ ਵੀ ਨਹੀਂ ਠੀਕ ਅਤੇ ਕਲਰ ਵੀ ਨਹੀਂ ਠੀਕ ਅਤੇ ਮੈਂ ਇਸਨੂੰ ਵੱਡੇ ਆਕਾਰ ਲਈ ਮੰਗਵਾਉਣ ਦੀ ਬੇਨਤੀ ਕਰਦੀ ਹਾਂ ਮੇਰੀ ਓਨਲਾਈਨ ਜੋ ਸ਼ੋਪਿੰਗ ਕੀਤੀ ਹੈ ਸੂਟ ਦੀ ਉਸ ਨੂੰ ਵਾਪਿਸ ਕਰਨ ਵਿੱਚ ਮੇਰੀ ਮਦਦ ਕਰੋ ਜੋ ਵਾਪਸੀ ਲਈ ਪਸੀਜਰ ਹੈ ਉਹ ਮੈਨੂੰ ਦੱਸਿਆ ਜਾਵੇ ਇਸ ਨੂੰ ਵੱਡੇ ਆਕਾਰ ਲਈ ਮੰਗਵਾਉਣ ਲਈ ਕੀ ਕਰਨਾ ਹੈ ਉਸ ਬਾਰੇ ਮੈਨੂੰ ਦੱਸਿਆ ਜਾਵੇ ਕਿਉਂਕਿ ਛੋਟੇ ਕੱਪੜੇ ਲਈ ਉਹ ਬੱਚੇ ਦਾ ਸਾਈਜ਼ ਹੈ ਮੇਰਾ ਸਾਈਜ਼ ਵੱਡਾ ਹੈ ਇਸ ਕਰਕੇ ਉਸਨੂੰ ਜਾਂਚ ਕੀਤੀ ਜਾਵੇ